ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿ

ਹਾਂਜੀ ਦੱਸੋ ਹਾਂਜੀ ਹਾਂਜੀ ਕਰੋ ਦੱਸੋ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਦੱਸੋ ਕੋਈ ਗੱਲ ਨਹੀਂ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਕੋਈ ਗੱਲ ਨਾ ਉਹ ਤਾਂ ਕੋਈ ਨਾ ਸਲਿਊਸ਼ਨ ਕੱਢ ਦਿੰਦੇ ਹਾਂ ਬਾਕੀ ਤੁਹਾਡੀ ਜਿੱਥੇ ਸੈਟਿੰਗ ਆਈ ਉੱਥੇ ਤੁਹਾਡੀ ਕਰ ਦਾਂਗੇ ਵੀ ਜਿੱਥੇ ਤੁਹਾਨੂੰ ਡਿਸਟਰਬੈਂਸ ਨਾ ਹੋਵੇ ਉੱਥੇ ਕਰ ਦਾਂਗੇ ਤੁਸੀਂ ਦੱਸੋ ਤੁਹਾਨੂੰ ਕਿੱਥੇ ਸੈਟ ਲੱਗ ਰਿਹਾ ਜੇ ਤੁਹਾਨੂੰ ਇੱਥੇ ਉੱਪਰ ਸਹੀ ਲੱਗ ਰਿਹਾ ਤਾਂ ਤੁਹਾਨੂੰ ਉਹ ਉੱਪਰ ਸ਼ਿਫਟ ਕਰਵਾ ਦਾਂਗੀ ਵੀ ਉੱਥੇ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋਵੇ ਹਾਂਜੀ ਇੱਥੇ ਤਾਂ ਸ਼ੋਰ ਹੁੰਦਾ ਬਾਕੀ ਤੁਹਾਨੂੰ ਜੇ ਕੋਈ ਲੱਗਦੀ ਹੈ ਜਗ੍ਹਾ ਵੀ ਜਿੱਥੇ ਮਤਲਬ ਡਿਸਟਰਬੈਂਸ ਨਾ ਹੋਵੇ ਅਤੇ ਤੁਸੀਂ ਉੱਥੇ ਦੇਖ ਲਓ ਫਿਰ ਤੁਹਾਨੂੰ ਉੱਧਰ ਸ਼ਿਫਟ ਕਰਵਾ ਦਾਂਗੇ ਹਾਂਜੀ ਹਾਂਜੀ ਮੈਂ ਕਰਵਾ ਦੂੰਗੀ ਬਾਕੀ ਇੱਧਰ ਨੀਅਰ ਇੱਕ ਜਗ੍ਹਾ ਹੈਗੀ ਉੱਥੇ ਮਤਲਬ ਕੁਛ ਸ਼ੋਰ ਸ਼ਰਾਬਾ ਨਹੀਂ ਆ ਇਹ ਤੋਂ ਥੋੜ੍ਹਾ ਜਿਹਾ ਦੂਰ ਆ ਅਤੇ ਉੱਥੇ ਬੱਚਿਆਂ ਨੂੰ ਵੀ ਕੋਈ ਤਕਲੀਫ ਨਹੀਂ ਆਉਗੀ ਅਤੇ ਤੁਹਾਨੂੰ ਵੀ ਮਤਲਬ ਕੋਈ ਦਿੱਕਤ ਨਹੀਂ ਆਉਂਗੀ ਜੇ ਤੁਸੀਂ ਉਹਨਾਂ ਨੂੰ ਸਿਖਾਂਗੇ ਹਾਂਜੀ ਹਾਂਜੀ ਉੱਪਰ ਵੀ ਹੈ ਉੱਪਰ ਜ਼ਿਆਦਾ ਆਵਾਜ਼ ਵੈਸੇ ਨਹੀਂ ਆਉਗੀ ਲਾਈਟਸ ਵਗੈਰਾ ਵੀ ਹੋਣਗੀਆਂ ਉੱਥੇ ਹਾਂਜੀ ਮਤਲਬ ਕਈ ਵਾਰੀ ਮਤਲਬ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਤੁਹਾਨੂੰ ਮਤਲਬ ਕਈ ਵਾਰੀ ਹਨੇਰਾ ਹੋ ਜਾਂਦਾ ਹੈਗਾ ਸ਼ਾਮ ਨੂੰ ਤੁਸੀਂ ਕਲਾਸ ਲਗਾਉਣੀ ਹੋਵੇ ਤਾਂ ਉੱਪਰ ਲਾਈਟਸ ਵਗੈਰਾ ਵੀ ਹੈਗੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ

ਹਾਂਜੀ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਹੋ ਸਹੀ ਕਰਦੇ ਆ ਪ੍ਰੈਕਟਿਸ ਬੱਚੇ ਹਾਂਜੀ ਹਾਂਜੀ ਓਕੇ ਠੀਕ ਹੈ ਠੀਕ ਠੀਕ